ਤੁਸੀਂ ਡੇਰੀ ਤੋਂ ਬੋਲਦੇ ਹੋ ਅੱਛਾ ਅਤੇ ਤੁਸੀਂ ਬਈ ਕੀ ਕੁਝ ਰੱਖਦੇ ਹੋ ਡੈਰੀ 'ਤੇ ਦੁੱਧ ਕਿਹੜੇ ਤਰ੍ਹਾਂ ਮਿਲ ਜਾਂਦਾ ਦੁੱਧ ਦੱਸੋ ਮੈਨੂੰ ਅੱਛਾ ਅੱਛਾ ਅੱਛਾ ਨਹੀਂ ਤੇ ਮੱਝ ਦਾ ਦੁੱਧ ਕੀ ਰੇਟ ਲਾਓਗੇ ਅੱਛਾ ਅਤੇ ਗਾਂ ਦਾ ਪਿਓਰ ਹੋਉਗਾ ਦੁੱਧ ਅੱਛਾ ਅਤੇ ਘਿਓ ਦੇਸੀ ਮਿਲ ਜਾਂਦਾ ਅੱਛਾ ਅਤੇ ਮੱਝ ਦੇ ਘਿਓ ਦਾ ਕੀ ਰੇਟ ਹੈ ਮੱਝ ਦਾ ਅੱਛਾ ਅਤੇ ਗਾਂ ਦਾ ਅੱਛਾ ਅਤੇ ਕਰੀਮ ਵੀ ਮਿਲ ਜਾਂਦੀ ਹੈ ਜੇ ਕਰੀਮ ਲੈਣੀ ਹੋਵੇ ਤਾਂ ਅੱਛਾ ਅੱਛਾ ਪਨੀਰ ਤਾਜ਼ਾ ਹੋਉਗਾ ਅੱਛਾ ਮੱਖਣ ਵਧੀਆ ਤਾਜ਼ਾ ਹੁੰਦਾ ਅੱਛਾ ਅਤੇ ਅੱਛਾ ਅੱਛਾ ਆਈਸਕ੍ਰੀਮ ਵਗੈਰਾ ਉਹ ਵੀ ਮਿਲ ਜਾਂਦੀਆਂ ਅੱਛਾ ਸੁੱਕਾ ਦੁੱਧ ਮਿਲਦਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਅਤੇ ਸਾਨੂੰ ਦੁੱਧ ਚਾਹੀਦਾ ਸਾਨੂੰ ਸੌ ਲੀਟਰ ਦੁੱਧ ਚਾਹੀਦਾ ਅੱਛਾ ਸ਼ਾਮ ਨੂੰ ਮਿਲਜੂਗਾ ਕੀ ਰੇਟ ਲਾਓਗੇ ਫਿਰ ਮੱਝ ਦਾ ਦੁੱਧ ਲਾਵਾਂਗੇ ਸੌ ਲੀਟਰ ਅੱਛਾ ਅਤੇ ਗਾਂ ਦਾ ਅੱਛਾ ਪੰਤਾਲੀ ਰੁਪਏ ਲਾਓਗੇ ਠੀਕ ਹੈ ਅਤੇ ਕਿਸ ਟਾਈਮ ਮਿਲ ਜਾਊਗਾ ਫਿਰ ਸ਼ਾਮ ਨੂੰ ਕਿ ਸੁਬਾਹ ਅੱਛਾ ਅੱਛਾ ਅਤੇ ਸੁਬਹਾ ਕਿੰਨੇ ਕਿਸ ਕੁ ਟਾਈਮ ਖੋਲ੍ਹਦੇ ਡੈਰੀ ਅੱਛਾ ਅੱਛਾ ਅੱਛਾ ਵਧੀਆ ਦੁੱਧ ਹੋਣਾ ਚਾਹੀਦਾ ਅੱਛਾ ਚਲੋ ਠੀਕ ਹੈ ਫਿਰ